ਇੰਡੀਅਨ ਆਈਡਲ ਵਰਗੇ ਟੀ ਵੀ ਸ਼ੋ ਮੈਂ ਬਹੁਤ ਦੇਖੇ ਨੇ ਜਿਵੇਂ ਕਪਿਲ ਸ਼ਰਮਾ ਸ਼ੋ ਉਸ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਨੂੰ ਕਪਿਲ ਸ਼ਰਮਾ ਦਾ ਸ਼ੋ ਆ ਜਿਹੜਾ ਉਹ ਬਹੁਤ ਪਸੰਦ ਆ ਉਹਦੇ ਵਿੱਚ ਸਾਨੂੰ ਅਲੱਗ ਅਲੱਗ ਰਾਜਾਂ ਦੇ ਲੋਕ ਦੇਖਣ ਨੂੰ ਮਿਲਦੇ ਨੇ ਉੱਥੋਂ ਦੀ ਭਾਸ਼ਾ ਉਹਨਾਂ ਦੇ ਰਹਿਣ ਸਹਿਣ ਉਹਨਾਂ ਦੀ ਬੋਲਚਾਲ ਸਿੱਖਣ ਨੂੰ ਮਿਲਦੀ ਹੈ ਸਾਡੀ ਜ਼ਿੰਦਗੀ ਵਿੱਚ ਉਹਨਾਂ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਕਿਉਂਕਿ ਸਾਨੂੰ ਉਹਨਾਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਉਹਨਾਂ ਦਾ ਰਹਿਣਾ ਉਹਨਾਂ ਦਾ ਪਹਿਰਾਵਾ ਉਹਨਾਂ ਦੀ ਸੋਚ ਅਲੱਗ ਅਲੱਗ ਰਾਜਾਂ ਤੋਂ ਹੀ ਅਸੀਂ ਆਪਣੇ ਪਰਿਵਾਰ ਨੂੰ ਪਿੰਡਾਂ ਨੂੰ ਬਿਹਤਰ ਬਣਾ ਸਕਦੇ ਹਾਂ ਕਿਉਂਕਿ ਜੇ ਅਸੀਂ ਕੁਛ ਦੇਖਾਂਗੇ ਹੀ ਨਹੀਂ ਤਾਂ ਅਸੀਂ ਸਿੱਖਾਂਗੇ ਕਿਵੇਂ